ਸੋਲ੍ਹਾਂ ਦਿਸੰਬਰ ਦੋ ਹਜ਼ਾਰ ਤੇਈ ਇੱਕ ਜਨਵਰੀ ਦੋ ਹਜ਼ਾਰ ਬਾਈ ਚੌਦਾਂ ਫਰਵਰੀ ਦੋ ਹਜ਼ਾਰ ਇੱਕੀ ਉੱਨੀ ਮਾਰਚ ਦੋ ਹਜ਼ਾਰ ਵੀਹ ਵੀਹ ਅਗਸਤ ਦੋ ਹਜ਼ਾਰ ਉੱਨੀ